ਸਤਿ ਸ਼੍ਰੀ ਅਕਾਲ ਜੀ ਨਾਇਕਾ ਤੋਂ ਗੱਲ ਕਰ ਰਹੇ ਹੋ ਮੈਂ ਆਖਰੀ ਵਾਰ ਇੱਕ ਆਰਡਰ ਕਰਿਆ ਸੀ ਇੱਕ ਜੀਨ ਦਾ ਪਰ ਉਹ ਜੀਨ ਦੀ ਜਗ੍ਹਾ ਉਹਨਾਂ ਨੇ ਜਿਹੜੀ ਹੈ ਇੱਕ ਲੋਅਰ ਭੇਜ ਦਿੱਤੀ ਲੋਅਰ ਦਾ ਜਿਹੜਾ ਸਾਈਜ਼ ਸੀ ਜੋ ਮੈਂ ਸਾਈਜ਼ ਆਰਡਰ ਕਰਿਆ ਸੀ ਉਹ ਤਾਂ ਆਇਆ ਨਹੀਂ ਮੀਡੀਅਮ ਸਾਈਜ਼ ਆਰਡਰ ਕਰਿਆ ਸੀ ਉਹ ਲਾਰਜ ਦੇ ਵਿੱਚ ਆ ਗਈ ਦੂਜੀ ਗੱਲ ਜਿਹੜਾ ਮੈਂ ਕਲਰ ਮੰਗਵਾਇਆ ਸੀ ਉਹ ਕਲਰ ਵੀ ਨਹੀਂ ਮੈਚ ਕਰ ਰਿਹਾ ਸੀ ਜਿਹੜਾ ਸਾਈਜ਼ ਸੀ ਉਹ ਵੀ ਲਾਰਜ ਸੀ ਅਤੇ ਕਲਰ ਵੀ ਨਹੀਂ ਮੈਚ ਕਰ ਰਿਹਾ ਸੀ ਦੂਜਾ ਕੁਆਲਿਟੀ ਮੈਂ ਸੋਚਿਆ ਕਿ ਚਲੋ ਲੋਅਰ ਹੀ ਵੀਅਰ ਕਰ ਲਵਾਂ ਪਰ ਜਿਹੜੀ ਉਹਦੀ ਕੁਆਲਿਟੀ ਸੀ ਉਹ ਕੁਆਲਿਟੀ ਵੀ ਹੀ ਇੰਨੀ ਬੁਰੀ ਸੀ ਇਸ ਕਰਕੇ ਮੈਂ ਅੱਗੇ ਤੋਂ ਤੁਹਾਡੇ ਤੋਂ ਕਦੇ ਵੀ ਕੋਈ ਚੀਜ਼ ਆਰਡਰ ਨਹੀਂ ਕਰਨੀ ਹੁਣ ਤਾਂ ਮੇਰੇ ਹੱਥ ਖੜ੍ਹੇ ਹੋ ਗਏ ਹੈ